ਹਾਂਜੀ ਖੇਤੀਬਾੜੀ ਵੀ ਇੱਕ ਜ਼ਰੂਰੀ ਹੈ ਜਿਹਦੇ ਮਤਲਬ ਕਿ ਖਾਣ ਪੀਣ ਆਪਣਾ ਖੇਤੀ ਦੇ ਸਿਰ 'ਤੇ ਹੀ ਚੱਲਦਾ ਕਣਕ ਵਗੈਰਾ ਜੀਰੀ ਵਗੈਰਾ ਜੋ ਵੀ ਆ ਅਲੱਗ ਅਲੱਗ ਤਰ੍ਹਾਂ ਦੀਆਂ ਖੇਤੀਆਂ ਕੀਤੀਆਂ ਜਾਂਦੀਆਂ ਨੇਗੀਆਂ ਪਰ ਪਾਣੀ ਦੀ ਹਰ ਇੱਕ ਦੇ ਲਈ ਜ਼ਰੂਰਤ ਪੈਂਦੀ ਹੈ ਪਾਣੀ ਦੇ ਬਿਨ੍ਹਾਂ ਕੋਈ ਵੀ ਚੀਜ਼ ਜੀਵਿਤ ਨਹੀਂ ਰਹਿ ਸਕਦੀ ਨਾ ਕਿ ਇਨਸਾਨ ਵੀ ਨਹੀਂ ਜੀਵਤ ਰਹਿ ਸਕਦਾ ਫ਼ਸਲ ਵੀ ਨਹੀਂ ਜੀਵਤ ਰਹਿ ਸਕਦੀ ਪਰ ਜੋ ਹੈ ਵੀ ਜਿੱਦਾਂ ਝੋਨਾ ਹੋ ਗਿਆ ਝੋਨਾ ਵੱਧ ਤੋਂ ਵੱਧ ਪਾਣੀ ਦੀ ਜ਼ਰੂਰਤ ਪੈਂਦੀ ਹੈ ਝੋਨੇ ਨੂੰ ਇਹਦੀ ਜਗ੍ਹਾ 'ਤੇ ਕੋਈ ਹੋਰ ਫ਼ਸਲਾਂ ਉਗਾਈਆਂ ਜਾਣ ਤਾਂ ਕਿ ਪਾਣੀ ਦਾ ਮਤਲਬ ਕਿ ਘੱਟ ਤੋਂ ਘੱਟ ਖੱਪਤ ਹੋ ਸਕੇ ਅਤੇ ਜਿੱਦਾਂ ਕਣਕ ਹੋ ਗਈ ਆਪਣੀ ਇਹ ਜਿੱਦਾਂ ਘੱਟ ਪਾਣੀ ਲੈਂਦੀਆਂ ਨੇਗੀਆਂ ਹੋਰ ਚੀਜ਼ਾਂ ਹੋ ਗਈਆਂ ਗੰਨਾ ਵਗੈਰਾ ਹੋ ਗਿਆ ਅਲੱਗਅਲੱਗ ਤਰ੍ਹਾਂ ਦੀਆਂ ਫ਼ਸਲਾਂ ਹੋ ਗਈਆਂ ਉਹਨਾਂ ਦੀ ਵੱਧ ਤੋਂ ਵੱਧ ਖੇਤੀ ਕੀਤੀ ਜਾਵੇ ਤਾਂ ਕਿ ਪਾਣੀ ਦੀ ਵੱਧ ਤੋਂ ਵੱਧ ਬੱਚਤ ਹੋ ਸਕੇ ਪੰਜਾਬ ਮਤਲਬ ਕੀ ਰੱਖਦਾ ਵੀ ਹਾਂ ਵੀ ਸਾਨੂੰ ਹੋਰ ਅਲੱਗ ਅਲੱਗ ਤਰ੍ਹਾਂ ਦੀਆਂ ਖੇਤੀਆਂ ਬਾਰੇ ਦੱਸਿਆ ਜਾਵੇ ਤਾਂ ਕਿ ਅਸੀਂ ਉਹ ਉਗਾਈਏ ਅਤੇ ਸਾਨੂੰ ਵੱਧ ਤੋਂ ਵੱਧ ਮੁਨਾਫ਼ਾ ਹੋ ਸਕੇ